ਵਿੱਚ ਹੈ ਨਾ ਦੂਜੇ ਸ਼ਹਿਰਾਂ ਦੇ ਮਾਮਲੇ ਬਹੁਤ ਅੱਗੇ ਆ ਹੈ ਨਾ ਵੈਸੇ ਤਾਂ ਸਾਰੇ ਸ਼ਹਿਰ ਹੀ ਦਿਨੋ ਦਿਨ ਹੁਣ ਅੱਗੇ ਆ ਰਹੇ ਆ ਜਿਵੇਂ ਜਿਵੇਂ ਉਹਨਾਂ ਵਿੱਚ ਸੁਵਿਧਾਵਾਂ ਪ੍ਰੋਵਾਈਡ ਹੁੰਦੀਆਂ ਨੇ ਹੈ ਨਾ ਉਵੇਂ ਉਵੇਂ ਸ਼ਹਿਰਾਂ ਨੂੰ ਕੀ ਹੈ ਕਿ ਉਹ ਵੀ ਅੱਗੇ ਆ ਰਹੇ ਨੇ ਅਤੇ ਤੈਕਨੋਲੋਜੀ ਦੇ ਮਾਮਲੇ ਵਿੱਚ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਨਾ ਲੁਧਿਆਣਾ ਲੁਧਿਆਣੇ ਸ਼ਹਿਰ ਵਿੱਚ ਵੀ ਬਹੁਤ ਵ ਵਧੀਆ ਕੰਪਨੀਜ਼ ਹੈਗੀਆਂ ਨੇ ਅਤੇ ਉਹਨਾਂ ਨੂੰ ਮਤਲਬ ਕਿ ਉੱਥੇ ਵੀ ਵਧੀਆ ਏ ਆਈ ਨਾਲ ਹਰ ਇੱਕ ਚੀਜ਼ ਮਤਲਬ ਕਿ ਹੈ ਹੈ ਨਾ ਉੱਥੇ ਵੀ ਤਕਨੋਲੋਜੀ ਬਹੁਤ ਐਡਵਾਂਸ ਹੈਗੀ ਐ ਅਤੇ ਵੈਸੇ ਤਾਂ ਹੁਣ ਸਾਰੇ ਸ਼ਹਿਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਨਾ ਅੱਗੇ ਆ ਹੀ ਰਹੇ ਨੇ ਅੱਜ ਕੱਲ੍ਹ ਬੱਚਿਆਂ ਨੂੰ ਸਕੂਲਾਂ ਵਿੱਚ ਵੀ ਏ ਆਈ ਨਾਲ ਪੜ੍ਹਾਇਆ ਜਾਂਦਾ ਹੈ ਨਾ ਜਿਵੇਂ ਪ੍ਰੋਜੈਕਟਰ ਵਗੈਰਾ ਨਾਲ ਬੱਚਿਆਂ ਨੂੰ ਲੈਬਸ ਵਗੈਰਾ ਹੈ ਨਾ ਉਸ ਤਰ੍ਹਾਂ ਮਤਲਬ ਪੜ੍ਹਾਇਆ ਜਾਂਦਾ ਆਰ ਓ ਟੀ ਲੈਬਸ ਵਗੈਰਾ ਜਿਵੇਂ ਅੱਜ ਕੱਲ੍ਹ ਹੈਗੀ ਆ ਸਕੂਲਾਂ ਵਿੱਚ ਹੈ ਨਾ ਅਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਬੱਚੇ ਸਾਡਾ ਆਉਣ ਵਾਲਾ ਭਵਿੱਖ ਆ ਉਸ ਤਰ੍ਹਾਂ ਨਾਲ ਕੀ ਹੈ ਕਿ ਪੰਜਾਬ ਵੀ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੇ ਭਵਿੱਖ ਲਈ ਤਿਆਰ ਕਰ ਰਿਹਾ ਉਹਨਾਂ ਨੂੰ ਏ ਆਈ ਦੀ ਨੌਲੇਜ ਦੇ ਰਿਹਾ ਹੈ ਨਾ ਤਕਨੋਲੋਜੀ ਦੀ ਨੌਲੇਜ ਦੇ ਰਿਹਾ ਹੈ ਨਾ ਅੱਜ ਕੱਲ੍ਹ ਜਿਵੇਂ ਛੇਵੀਂ 'ਚ ਕਲਾਸ ਵਿੱਚ ਬੱਚਿਆਂ ਨੂੰ ਕੰਪਿਊਟਰ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਸਰਕਾਰੀ ਸਕੂਲਾਂ ਵਿੱਚ ਹੈ ਨਾ ਤਾਂ ਕੀ ਹੈ ਕਿ ਮਤਲਬ ਉਹਨਾਂ ਦਾ ਆਪਣਾ ਮਕਸਦ ਇਹੀ ਹੈ ਵੀ ਚਲੋ ਹੈ ਨਾ ਆਪਣੇ ਬੱਚਿਆਂ ਨੂੰ ਵਧੀਆ ਤਕਨੋਲੋਜੀ ਦੀ ਨੌਲੇਦ ਆਵੇ ਅਤੇ ਇਸ ਨਾਲ ਕੀ ਹੈ ਕਿ ਆਪਣਾ ਪੰਜਾਬ ਹੋਰ ਜ਼ਿਆਦਾ ਤਰੱਕੀ ਕਰੂਗਾ ਹੈ ਨਾ ਆਪਣੇ ਬੱਚੇ ਵੱਡੀਆਂ ਵੱਡੀਆਂ ਆਪਣੇ ਪੰਜਾਬ ਦੇ ਬੱਚੇ ਪੰਜਾਬ ਦਾ ਨੌਜਵਾਨ ਹੈ ਨਾ ਕਿ ਕਿ ਵੱਡੀਆਂ ਵੱਡੀਆਂ ਕੰਪਨੀਆਂ 'ਚ ਜੋਬ ਮਤਲਬ ਕਿ ਹੈ ਨਾ ਜੋਬਸ ਕਰਨਗੇ ਵਧੀਆ ਪੰਜਾਬ ਦੀ ਤਰੱਕੀ ਹੋਊਗੀ ਹੈ ਨਾ ਸੋ ਉਮੀਦ ਹੈ ਕਿ ਪੰਜਾਬ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦਾ ਰਹੇ